ਹੈਲੋ ਹਾਂਜੀ ਗਿੱਲ ਰੈਸਟੋਰੈਂਟ ਤੋਂ ਬੋਲਦੇ ਹੋ ਜੀ ਮੇਰਾ ਇੱਕ ਔਡਰ ਸੀ ਮੇਰਾ ਦੋਸਤ ਜੋ ਕਿ ਬਹੁਤ ਟਾਈਮ ਬਾਅਦ ਮੈਨੂੰ ਮਿਲਣ ਲਈ ਆ ਰਿਹਾ ਉਹਦੇ ਲਈ ਮੈਂ ਵਧੀਆ ਅਤੇ ਸਵਾਦਿਸ਼ਟ ਭੋਜਣ ਜੋ ਕਿ ਤੁਹਾਡੇ ਰੈਸਟੋਰੈਂਟ ਤੋਂ ਮੈਂ ਔਡਰ ਕਰਨਾ ਉਹਦੇ ਵਿੱਚ ਮੈਨੂੰ ਦਾਲ ਮੱਖਣੀ ਪਨੀਰ ਅਤੇ ਸਿੰਪਲ ਅਤੇ ਸਾਦੀ ਰੋਟੀ ਵਧੀਆ ਦੇਸੀ ਘਿਓ ਨਾਲ ਚੋਪੜ ਕੇ ਅਤੇ ਥੋੜ੍ਹਾ ਜਿਹਾ ਖ਼ਾਸ ਧਿਆਨ ਦਿੱਤਾ ਜਾਵੇ ਕਿ ਮੇਰਾ ਦੋਸਤ ਰਾਤ ਨੂੰ ਲੇਟ ਆ ਰਿਹਾ ਅਤੇ ਕਿਰਪਾ ਕਰਕੇ ਉਸ ਨੂੰ ਐਸੇ ਬੌਕਸ ਵਿੱਚ ਪੈਕ ਕਰਕੇ ਭੇਜੋ ਤਾਂ ਕਿ ਭੋਜਨ ਨਾ ਤਾਂ ਗਰਮ ਹੋਵੇ ਮਤਲਬ ਕਿ ਬੇਸੁਵਾਦਾ ਨਾ ਹੋਵੇ ਅਤੇ ਨਾ ਹੀ ਉਹ ਖ਼ਰਾਬ ਹੋਵੇ ਉਸ ਦਾ ਜੋ ਟੇਸਟ ਹੈ ਉਹ ਦੇਰ ਤੱਕ ਉਵੇਂ ਹੀ ਬਣਿਆ ਰਹੇ ਠੀਕ ਹੈ ਸਰ ਇਸ ਭੋਜਨ ਨੂੰ ਥੋੜ੍ਹਾ ਜਿਹਾ ਧਿਆਨ ਨਾਲ ਅਤੇ ਸਮੇਂ ਸਿਰ ਪਹੁੰਚਾਉਣ ਦੀ ਕੋਸ਼ਿਸ਼ ਕਰੋ